ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਫੋਨ ਕਿੱਥੇ ਲਾਇਆ ਪਹਿਲਾਂ ਇਹ ਦੱਸੋ ਹਾਂਜੀ ਰੂੜੇਕੇ ਥਾਣੇ ਚੋਂ ਕਰਦੇ ਪਰ ਐਵੇਂ ਦੱਸੋ ਨਾ ਪਹਿਲਾਂ ਵੀ ਹਾਂ ਅੱਛਾ ਅੱਛਾ ਪੁੱਛੋ ਜਾ ਕੇ ਪਰ ਤੁਹਾਨੂੰ ਇੱਕ ਵਾਰ ਥਾਣੇ ਆ ਕੇ ਰਿਪੋਰਟ ਕਰਨੀ ਪਊ ਲਿਖਤੀ ਅੱਛਾ ਠੀਕ ਹੈ ਤੁਹਾਨੂੰ ਇੱਕ ਵਾਰ ਤੁਹਾਨੂੰ ਥਾਣਾ ਰੂੜੇਕੇ ਵਿੱਚ ਆਉਣਾ ਪਊਗਾ ਉੱਥੇ ਤੁਹਾਨੂੰ ਲਿਖਤੀ ਰਿਪੋਰਟ ਲਿਖਾਉਣੀ ਪਊ ਅਤੇ ਆਪਣਾ ਨੰਬਰ ਤੁਸੀਂ ਜੀਹਦੇ 'ਤੇ ਫੋਨ ਆਉਂਦੇ ਜਿਹੜੇ ਨੰਬਰ ਤੋਂ ਫੋਨ ਅਉਂਦੇ ਉਹ ਸਾਨੂੰ ਸਾਰਾ ਕਰਾਉਣਾ ਪਊ ਅਸੀਂ ਉਹਦੀ ਲੋਕੇਸ਼ਨ ਚੱਕ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਵਈ ਕੌਣ ਕਰ ਰਿਹਾ ਇਹ ਠੀਕ ਹੈ ਜਿਹੜਾ ਵੀ ਫਰੋਡ ਹੋ ਰਿਹੈ ਇਹ ਸਖ਼ਤ ਕਾਰਵਾਈ ਤੁਸੀਂ ਦੇਖੀ ਚੱਲਿਓ ਬਸ ਜਿਵੇਂ ਕਹੋਂਗੇ ਓਵੇਂ ਹੀ ਕਰਦਾਂਗੇ ਆਪਾਂ ਸਖ਼ਤ ਤੋਂ ਸਖ਼ਤ ਸਜਾ ਦੇਵਾਂਗੇ ਆਪਾਂ ਠੀਕ ਹੈ ਪੂੰਛ ਚਕਾਦਾਂਗੇ ਆਪਾਂ ਕੋਈ ਚੱਕਰ ਨਹੀਂ ਸਾਰਿਆਂ ਦੀ ਠੀਕ ਹੈ ਓਕੇ ਜੀ ਚੱਲੋ ਆਪਾਂ ਫਿਰ ਬਹੇ